ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਖ ਕਾਰਨ ਹੈ ਕਰਜ਼ੇ ਹੁਣ ਕਈ ਕਿਸਾਨ ਇਸ ਲਈ ਵੀ ਖੁਦਕੁਸ਼ੀਆਂ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਫਸਲਾਂ ਉੱਤੇ ਜ਼ਿਆਦਾ ਜ਼ਮੀਨਾਂ ਉੱਤੇ ਜ਼ਿਆਦਾ ਕਰਜ਼ੇ ਚੱਕ ਲੈਂਦੇ ਹਨ ਅਤੇ ਆਪਣੀ ਖੇਤੀ ਉਨ੍ਹਾਂ ਦੀ ਛੋਟੀ ਹੁੰਦੀ ਹੈ ਅਤੇ ਸੰਦ ਬੜਾ ਰੱਖ ਲੈਂਦੇ ਹਨ ਜਿਵੇਂ ਕਿ ਵੱਡੇ ਟਰੈਕਟਰ ਵੱਡੇ ਟਰਾਲੇ ਲੋਕਾਂ ਨੂੰ ਦਿਖਾਉਣ ਦੇ ਮਾਰੇ ਕਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਾਰਨ ਹੋਰ ਵੀ ਹੁੰਦਾ ਹੈ ਜਿਵੇਂ ਕਿ ਫਸਲਾਂ 'ਤੇ ਕੁਦਰਤੀ ਮਾਰ ਪੈ ਜਾਂਦੀ ਹੈ ਜਿਵੇਂ ਕਿ ਹੁਣੀ ਆਪਾਂ ਦੇਖਿਆ ਹੈ ਪੰਜਾਬ ਵਿੱਚ ਹੜ੍ਹ ਹੋ ਗਏ ਲੋਕਾਂ ਨੇ ਤਿੰਨ ਤਿੰਨ ਵਾਰ ਝੋਨਾ ਲਾਇਆ ਪਰ ਤਿੰਨੋਂ ਵਾਰ ਉਨ੍ਹਾਂ ਦਾ ਝੋਨਾ ਹੜ੍ਹਾਂ ਨਾਲ਼ ਜਮ੍ਹਾ ਹੀ ਖਰਾਬ ਹੋ ਗਿਆ ਹੈ ਅਤੇ ਉਨ੍ਹਾਂ ਨੇ ਜਿਨ੍ਹਾਂ ਨੇ ਠੇਕੇ 'ਤੇ ਜ਼ਮੀਨਾਂ ਚੱਕੀਆਂ ਹੋਈਆਂ ਹਨ ਉਹ ਉਹ ਉਹ ਉਨ੍ਹਾਂ ਦਾ ਹੁਣ ਠੇਕਾ ਨਹੀਂ ਨਿਕਲਣਾ ਅਤੇ ਉਹ ਇੱਕ ਤਰ੍ਹਾਂ ਦੇ ਟੈਨਸ਼ਨਾਂ ਵਿੱਚ ਹਨ ਜੋ ਕਿ ਅੱਗੇ ਸ਼ਾਇਦ ਖੁਦਕੁਸ਼ੀਆਂ ਦਾ ਰਾਹ ਬਣ ਸਕਦਾ ਹੈ ਪਰ ਜ਼ਿਆਦਾਤਰ ਕਿਸਾਨ ਸ਼ੋਸ਼ੇਬਾਜ਼ੀ ਵਿੱਚ ਪੈ ਜਾਂਦੇ ਪੈ ਗਏ ਹਨ ਲਾਈਕ ਜ਼ਿਆਦਾਤਰ ਵੱਡੀਆਂ ਗੱਡੀਆਂ ਲਿਆਉਂਦੇ ਹਨ ਕਰਜ਼ੇ ਚੁੱਕ ਕੇ ਅਤੇ ਉਹ ਬੈਂਕਾਂ ਦਾ ਫਿਰ ਕਰਜ਼ਾ ਲਹਿੰਦਾ ਨਹੀਂ ਫਿਰ ਬੈਂਕ ਜਮੀਨਾਂ ਖੋਹ ਲੈਂਦੇ ਹਨ ਜੋ ਕਿ ਜਿਵੇਂ ਕਿ ਉਨ੍ਹਾਂ ਨੇ ਐਗਰੀਮੈਂਟ ਵਿੱਚ ਲਿਖਿਆ ਹੁੰਦਾ ਹੈ ਇਸ ਤੋਂ ਬਚਣ ਦਾ ਇਹੀ ਰਾਹ ਹੈ ਅਤੇ ਕਿਸਾਨ ਆਪਣੀ ਫ਼ਸਲਾਂ 'ਤੇ ਵੱਧ ਧਿਆਨ ਦੇਣ ਸ਼ੋਸ਼ੇਬਾਜ਼ੀਆਂ ਨੂੰ ਛੱਡ ਕੇ ਅਤੇ ਉਹ ਆਪਣੀ ਵੀ ਫ਼ਸਲ ਜਿੰਨਾ ਜਿੰਨੀ ਕੁ ਉਨ੍ਹਾਂ ਦੀ ਖੇਤੀ ਆ ਓਡਾ ਹੀ ਸੰਦ ਵਰਤੇ ਅਤੇ ਪੁਰਾਣੀ ਪੁਰਾਣੇ ਬਾਬਿਆਂ ਦੀ ਜੋ ਕਿ ਫ਼ਸਲ ਕਰਨੇ ਦਾ ਤਰੀਕਾ ਸੀ ਨੈਚੁਰਲ ਤਰੀਕਾ ਸੀ ਉਹ ਉਨ੍ਹਾਂ ਨੂੰ ਦੁਬਾਰਾ ਲਿਆਇਆ ਜਾਵੇ ਜਿਸ ਨਾਲ਼ ਬਿਮਾਰੀਆਂ ਵੀ ਘੱਟਦੀਆਂ ਹਨ ਹੁਣ ਨਵੇਂ ਨਵੇਂ ਕੈਮੀਕਲ ਆ ਗਏ ਹਨ ਜਿਸ ਨਾਲ਼ ਫ਼ਸਲ ਦੀ ਗ੍ਰੋਥ ਵੀ ਘੱਟਦੀ ਹੈ ਅਤੇ ਨਵੀਂ ਨਵੀਂ ਬਿਮਾਰੀਆਂ ਵੀ ਉਤਪਾਦ ਹੁੰਦੀਆਂ ਹਨ ਅਤੇ ਉਹ ਅੱਗੇ ਜਾ ਕੇ ਜੋ ਲੋਕ ਖਾਂਦੇ ਹਨ ਉਨ੍ਹਾਂ ਲਈ ਵੀ ਜ਼ਹਿਰ ਬਣਦੀਆਂ ਹਨ ਅਤੇ ਸਰਕਾਰ ਨੂੰ ਕੁਝ ਕੁਦ ਕਦਮ ਚੁੱਕਣੇ ਚਾਹੀਦੇ ਹਨ ਜਿਵੇਂ ਕਿ ਸਰਕਾਰ ਨੂੰ ਫ਼ਸਲ ਜੋ ਕਿ ਹੁੰਦੀ ਹੈ ਉਹ 'ਤੇ ਉਨ੍ਹਾਂ ਦੇ ਸੰਦਾਂ 'ਤੇ ਸਬਸਿਡੀਆਂ ਦੇਣੀਆਂ ਚਾਹੀਦੀਆਂ ਹਨ ਅਤੇ ਜਿਵੇਂ ਕਿ ਸਰਕਾਰ ਉਨ੍ਹਾਂ ਦੇ ਪਿਛਲੇ ਰਿਕੋਰਡ ਦੇਖ ਕੇ ਉਨ੍ਹਾਂ ਨੂੰ ਉੱਨਾਂ ਹੀ ਕਰਜਾ ਦਿੱਤਾ ਜਾਵੇ ਜਿਸ ਨਾਲ਼ ਲੋਕ ਕਰਜ਼ੇ ਥੱਲੇ ਘੱਟ ਦੱਬੂਗੇ ਅਤੇ ਕਿਸਾਨਾਂ ਨੂੰ ਵੀ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਹੈ ਉਹ ਵੀ ਮਹਿੰਗੇ ਪੈਸਟੀਸਾਈਡਸ ਮਹਿੰਗੀਆਂ ਦਵਾਈਆਂ ਸਪਰੇਆਂ ਰੇਹਾਂ ਸਪਰੇਆਂ ਨਾ ਵਰਤਣ ਪੁਰਾਣੇ ਪੁਰਾਣੇ ਤਰੀਕੇ ਵਰਤਣ ਖੇਤੀ ਕਰਨ ਦੇ ਜਿਸ ਨਾਲ਼ ਵ ਵਧੀਆ ਉਤਪਾਦ ਪੈਦਾ ਹੋ ਸਕਦੀ ਹੈ ਫ਼ਸਲ ਵਿੱਚ ਵਾਧਾ ਆ ਸਕਦਾ ਹੈ ਬਿਮਾਰੀਆਂ ਘੱਟ ਸਕਦੀਆਂ ਹਨ